ਪੰਦਰਾ ਅਗਸਤ ਉੱਨੀ ਸੋ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਅੱਠ ਜੁਲਾਈ ਉੱਨੀ ਸੌ ਚੁਰਾਸੀ ਦੋ ਮਈ ਦੋ ਹਜ਼ਾਰ ਦਸ ਉੱਨੀ ਸਤੰਬਰ ਉੱਨੀ ਸੌ ਪਚਾਸੀ